ਹਾਂਜੀ ਮੈਨੂੰ ਲੱਗਦਾ ਹੈ ਕਿ ਇਤਿਹਾਸ ਦੇ ਬਾਰੇ ਬਿਲਕੁਲ ਆਪਣੇ ਬੱਚਿਆਂ ਨੂੰ ਜਾਣੂ ਹੋਣਾ ਚਾਹੀਦਾ ਇਤਿਹਾਸ ਨੂੰ ਦੇਖਦੇ ਹੋਏ ਇਹ ਪਤਾ ਲੱਗਦਾ ਹੈ ਕਿ ਸਾਡੇ ਇੱਥੇ ਇਤਿਹਾਸਕਾਰਾਂ ਨੇ ਕੀ ਕ ਕੀ ਗਲਤੀਆਂ ਕੀਤੀਆਂ ਕੀ ਕ ਕੀ ਕੀ ਉਹਨਾਂ ਦਾ ਰਹਿਣਾ ਸਹਿਣਾ ਸੀਗਾ ਇੱਦਾਂ ਪਤਾ ਹੋਣਾ ਚਾਹੀਦਾ ਗਾ ਹੈ ਨਾ ਅਤੇ ਇਤਿਹਾਸ ਦੇ ਵਿੱਚੋਂ ਬਹੁਤ ਸਾਰੀਆਂ ਅਹਿਜੀਆਂ ਉਦਾਹਰਨਾਂ ਮਿਲਦੀਆਂ ਜੋ ਜ਼ਿੰਦਗੀ ਦੇ ਵਿੱਚ ਬਹੁਤ ਕੰਮ ਆਉਂਦੀਆਂ ਸੋ ਇਤਿਹਾਸ ਨੂੰ ਹਰ ਬੱਚੇ ਨੂੰ ਜਾਣਨਾ ਚਾਹੀਦਾ ਗਾ ਆਪਣੇ ਵੀ ਬੱਚਿਆਂ ਨੂੰ ਮੈਂ ਕਹਾਣੀਆਂ ਬਿਲਕੁਲ ਸੁਣਾਉਂਦਾ ਹਾਂ ਜੀ ਇਤਿਹਾਸ ਦੀਆਂ ਰਮਾਇਣ ਦੀਆਂ ਹੋ ਗਈਆਂ ਸਿੱਖ ਇਤਿਹਾਸ ਹੋ ਗਿਆ ਹਿੰਦੂ ਹੋਰ ਨਵਿਆਂ ਦਾ ਇਤਿਹਾਸ ਹੋ ਗਿਆ ਕਾਫ਼ੀ ਇਤਿਹਾਸਕਾਰਾਂ ਕਹਾਣੀਆਂ ਪੜ੍ਹਦਾ ਵੀ ਹਾਂ ਮੈਂ ਅਤੇ ਬੱਚਿਆਂ ਨੂੰ ਸੁਣਾ ਨਾ ਵੀ ਹਾਂ ਅਤੇ ਬਿਲਕੁਲ ਇਤਿਹਾਸ ਇੱਕ ਐਸੀ ਚੀਜ਼ ਹੈ ਐਸਾ ਐਸਾ ਇੱਕ ਐਸੀ ਐਸੀ ਇੱਕ ਚੀਜ਼ ਹੈ ਕਿ ਕਹਿਣ ਦਾ ਮਤਲਬ ਹਰ ਚੀ ਹਰ ਬੰਦੇ ਨੂੰ ਉਸਦੀ ਨੌਲਜ ਹੋਣੀ ਚਾਹੀਦੀ ਹੈ ਬੱਚਿਆਂ ਨੂੰ ਵੀ ਬਿਲਕੁਲ ਇਤਿਹਾਸ ਦੇ ਬਾਰੇ ਬਿਲਕੁਲ ਪਤਾ ਹੋਣਾ ਚਾਹੀਦਾ ਗਾ ਜੀ